ਹੈਲੋ ਹਾਂਜੀ ਸਾਹਿਬ ਢਾਬੇ ਤੋਂ ਬੋਲਦੇ ਜੀ ਮੈਂ ਜਗਦੀਪ ਸਿੰਘ ਮਾਣੇਵਾਲ ਬੋਲਦਾ ਮਾਣੇਵਾਲ ਪਿੰਡ ਤੋਂ ਪਛਾਣਿਆ ਹਾਂਜੀ ਹਾਂਜੀ ਭਾਜੀ ਉਹ ਸਾਡੇ ਨਾ ਰਿਸ਼ਤੇਦਾਰ ਆਏ ਓ ਸੀਗੇ ਅਤੇ ਸਾਨੂੰ ਨਾ ਅ ਅਸੀਂ ਕੁਛ ਔਰਡਰ ਕਰਨਾ ਆ ਇੱਕ ਤਾਂ ਦਾਲ ਮੱਖਣੀ ਏ ਕੁਆਂਟਿਟੀ ਵਿੱਚ ਦੋ ਕਰ ਦਿਓ ਇੱਕ ਸ਼ ਸ਼ਾਹੀ ਪਨੀਰ ਸਾਹੀ ਪਨੀਰ ਵੀ ਦੋ ਕਰ ਦਿਓ ਹਾਂਜੀ ਅਤੇ ਇੱਕ ਨਾਲ ਮਿਕਸ ਵੈੱਜ ਕਰ ਦਿਓ ਅਤੇ ਰੋਟੀਆਂ ਕਿਹੜੀਆਂ ਪਲੇਨ ਹਾਂਜੀ ਪਲੇਨ ਨਾਨ ਪਲੇਨ ਨਾਨ ਕਰਿਓ ਹਾਂਜੀ ਉੱਪਰੋਂ ਚੋਪੜਿਓ ਨਾ ਪਲੇਨ ਏ ਰੱਖਿਓ ਏ ਕਰ ਦੋ ਤੁਸੀਂ ਵੀਹ ਕੁ ਕਰ ਦਿਓ ਜੀ ਹਾਂਜੀ ਅਤੇ ਹਾਂਜੀ ਨਾਲ ਸੈਲਡ ਸੈਲਡ ਆਪਣੇ ਹਿਸਾਬ ਨਾਲ ਪਾ ਦਿਓ ਠੀਕ ਹੈ ਜੀ ਅਤੇ ਨਾਲ ਨਾ ਏ ਮੈਂ ਆ ਗਿਆ ਵੀ ਸ ਤੁਸੀਂ ਇਹਨੂੰ ਤਿਆਰ ਰੱਖਿਓ ਰੈਡੀ ਤੁਹਾਡੇ ਕੋਲ ਆ ਗਿਆ ਮੈਂ ਲਗਭਗ ਪੱਚੀ ਕੁ ਮਿੰਟਾਂ ਤੱਕ ਆ ਗਿਆ ਪੱਚੀ ਤੀਹ ਮਿੰਟਾਂ ਤੱਕ ਤੁਸੀਂ ਤਿਆਰ ਰੱਖਿਓ ਕੋਈ ਨਹੀਂ ਮੈਂ ਇੱਥੇ ਆ ਕੇ ਬਿੱਲ ਪੇਅ ਕਰਦਾ ਨਾਲ਼ੇ ਠੀਕ ਹੈ ਜੀ ਧੰਨਵਾਦ ਜੀ